ਪੰਜਾਬੀ ਆਪਣੀ ਭਾਸ਼ਾ ਪੰਜਾਬੀ ਦੀ ਵਰਤੋਂ ਆਪਣੀ ਪਛਾਣ ਅਤੇ ਸਾਂਝ ਦੀ ਭਾਵਨਾ ਦੇ ਇੱਕ ਅਹਿਮ ਪ੍ਰਗਟਾਵੇ ਵਜੋਂ ਕਰਦੇ ਹਨ ਭਾਸ਼ਾ ਇੱਕ ਸੱਭਿਆਚਾਰਕ ਪੁੱਲ ਦਾ ਕੰਮ ਕਰਦੀ ਹੈ ਉਹਨਾਂ ਨੂੰ ਉਹਨਾਂ ਦੀ ਵਿਰਾਸਤ ਪਰੰਪਰਾਵਾਂ ਅਤੇ ਭਾਈਚਾਰੇ ਨਾਲ ਜੋੜਦੀ ਹੈ ਪੰਜਾਬੀ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਸਗੋਂ ਸੱਭਿਆਚਾਰਕ ਕਦਰਾਂ ਲੋਕਧਾਰਾ ਅਤੇ ਇਤਿਹਾਸ ਨੂੰ ਸੰਭਾਲਣ ਅਤੇ ਪ੍ਰਸਾਰਿਤ ਕਰਨ ਦਾ ਇੱਕ ਜਹਾਜ਼ ਹੈ ਕਹਾਵਤਾਂ ਕਵਿਤਾਵਾਂ ਅਤੇ ਗੀਤਾਂ ਦੀ ਭਰਪੂਰ ਲੜੀ ਰਾਹੀਂ ਪੰਜਾਬੀ ਡੂੰਘੇ ਭਾਵਨਾ ਤੁੰਗ ਅਤੇ ਸਭਿਆਚਾਰਕ ਆਦਤਾਂ ਨੂੰ ਪ੍ਰਗਟ ਕਰਦੇ ਹਨ ਜੋ ਉਹਨਾਂ ਦੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਉਹਨਾਂ ਤਿਉਹਾਰਾਂ ਧਾਰਮਿਕ ਰਸਮਾਂ ਅਤੇ ਰੋਜ਼ਾਨਾ ਗੱਲਬਾਤ ਅਕਸਰ ਪੰਜਾਬੀ ਆਲੇ ਦੁਆਲੇ ਕੇਂਦਰਿਤ ਹੁੰਦੀ ਹੈ ਇਸ ਨੂੰ ਸੱਭਿਆਚਾਰਕ ਨਿਰੰਤਰਤਾ ਦਾ ਇੱਕ ਜੀਵਿਤ ਪ੍ਰਗਟਾਵਾ ਮੰਨਦੀ ਹੈ ਇਸ ਤੋਂ ਇਲਾਵਾ ਭਾਸ਼ਾ ਪਰਿਵਾਰਕ ਬੰਧਨਾਂ ਨੂੰ ਬਣਾਈ ਰੱਖਣ ਅਤੇ ਨੌਜਵਾਨ ਪੀੜ੍ਹੀਆਂ ਨੂੰ ਉਹਨਾਂ ਦੀਆਂ ਜੜ੍ਹਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਡਾਈਸਪੋਰਿਕ ਸੰਦਰਭਾਂ ਵਿੱਚ ਪੰਜਾਬੀ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵਿੱਚ ਇੱਕ ਸਾਮੂੰਹਿਕ ਪਛਾਣ ਨੂੰ ਉਤਸਾਹਿਤ ਕਰਦੇ ਹੋਏ ਵਤਨ ਨਾਲ ਇੱਕ ਸੱਭਿਆਚਾਰਕ ਸੰਬੰਧ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਜੀਵਨ ਦੇ ਵੱਖ ਵੱਖ ਪਹਿਲੂਆਂ ਵਿੱਚ ਆਪਣੀ ਭਾਸ਼ਾ ਤਾਂ ਜਸ਼ਨ ਮਨਾ ਕੇ ਵਰਤ ਕੇ ਪੰਜਾਬੀ ਆਪਣੀ ਸੱਭਿਆਚਾਰਕ ਵਿਲੱਖਣਤਾ ਦੀ ਪੁਸ਼ਟੀ ਕਰਦੇ ਹਨ ਅਤੇ ਆਪਣੀ ਵਿਰਾਸਤ ਨਾਲ ਆਪਣੀ ਸਾਂਝ ਨੂੰ ਮਜ਼ਬੂਤ ਕਰਦੇ ਹਨ